ਮੈਂ ਕਢਾਈਆਂ ਵਾਲੇ ਟਾਂਕੇ ਬਹੁਤ ਕੀਤੇ ਹੋਏ ਨੇ ਚੋਪ ਟਾਂਕਾ ਸਿੰਦੀ ਟਾਂਕਾ ਸਿੱਧਾ ਬੱਖਾ ਅਤੇ ਪੱਥਰ ਟਾਂਕਾ ਸ਼ੇਡ ਜਿਹਦੇ 'ਚ ਮੈਨੂੰ ਸਿੰਧੀ ਟਾ ਟਾਂਕਾ ਸਿੱਖਣ ਵਿੱਚ ਥੋੜ੍ਹੀ ਦਿੱਕਤ ਆਈ ਥੋੜ੍ਹਾ ਚੁਣੌਤੀਪੂਰਨ ਜਿਹਾ ਲੱਗਿਆ ਉਹ ਥੋੜ੍ਹਾ ਔਖਾ ਲੱਗਿਆ ਜਿਵੇਂ ਅਤੇ ਇੱਕ ਵਾਰ ਕੱਪੜੇ ਸਿਉਣ ਵਿੱਚ ਮੈਨੂੰ ਮੈਂ ਨਾਲ ਲਹਿੰਗਾ ਸਿਉਣ ਲੱਗੀ ਤਾਂ ਲਹਿੰਗ ਪਹਿਲੇ ਮੈਂ ਉਹਦੇ 'ਤੇ ਸਾਰੇ 'ਤੇ ਕਢਾਈ ਕੀਤੀ ਹੈਗੀ ਫਿਰ ਉਹਨੂੰ ਕਲੀਆਂ ਕਟ ਕਲੀਆਂ ਵਾਲਾ ਸੀਗਾ ਉਹ ਕਲੀਆਂ ਕੱਟ ਕੱਟ ਕੇ ਉਹਦਾ ਬਣਾਉਣਾ ਸੀਗਾ ਉਨਦ ਉਹਦੇ ਥੱਲੇ ਲਾਈਨਿੰਗ ਵੀ ਲੱਗਣੀ ਸੀਗੀ ਅਸ ਅਸਤਰ ਵੀ ਲੱਗਣਾ ਸੀਗਾ ਉਹਦੇ ਥੱਲੇ ਅਤੇ ਉ ਉਹਦੇ 'ਤੇ ਮੈਨੂੰ ਬਹੁਤ ਜ਼ਿਆਦਾ ਟੈਮ ਲ ਬਹੁਤ ਜ਼ਿਆਦਾ ਟਾਈਮ ਟੈਮ ਲੱਗਿਆ ਹੋਰ ਡਿਜਾਈਨਰ ਜਿਹਾ ਬਣਾਉਣਾ ਸੀਗਾ ਉਹ ਮੇਰੇ ਵਾਸਤੇ ਬਹੁਤ ਚੁਣੌਤੀਪੂਰਨ ਹੈਗਾ ਸੀਗਾ ਕਿਉਂਕਿ ਉਹਨੂੰ ਮੈਂ ਕਦੇ ਬਣਾਇਆ ਨਹੀਂ ਸੀ ਪਹਿਲੀ ਵਾਰ ਬਣਾ ਰਹੀ ਸੀ ਤਾਂ ਮੈਨੂੰ ਫਿਰ ਉਹਨੂੰ ਗ ਕੱਟਣ 'ਤੇ ਸੀਨ 'ਤੇ ਬਹੁਤ ਜ਼ਿਆਦਾ ਮੈਨੂੰ ਦਿਮਾਗ ਵੀ ਲਗਾਉਣਾ ਪਿਆ ਅਤੇ ਮੈਨੂੰ ਟੈਮ ਵੀ ਬਹੁਤ ਲੱਗਿਆ ਹੈਗਾ ਉਹਦੇ 'ਤੇ ਮੈਂ ਸਿੱਪੀਆਂ ਮੋਤੀ ਵੀ ਲਗਾਏ ਹੈਗੇ ਕਢਾਈ ਵੀ ਕੀਤੀ ਹੈਗੀ ਅਤੇ ਅ ਸਿੱਪੀਆਂ ਮੋਤੀ ਵਾਲਾ ਉਹ ਵ ਵਰਕ ਅਸੀਂ ਉਹਦੇ 'ਤੇ ਕਢਾਈ ਵੀ ਕੀਤੀ ਉਹਦੇ 'ਤੇ ਮੈਨੂੰ ਟਾ ਬਹੁਤ ਟੈਮ ਲੱਗਿਆ ਉਹਦੀ ਚੋਲੀ ਜਿਹੜੇ ਬਲੋਜ ਸਿਉਣਾ ਸੀਗਾ ਉਹ ਵੀ ਨੈਟ ਵਾਲਾ ਸੀਗਾ ਨੈੱਟ ਵਾਲਾ ਕੱਪੜਾ ਮਸ਼ੀਨ ਬਹੁਤ ਔਖਾ ਖਿੱਚ ਰਹੀ ਸੀਗੀ ਉਹਦੇ 'ਤੇ ਵੀ ਮੈਨੂੰ ਬਹੁਤ ਟਾਈਮ ਲੱਗ ਗਿਆ ਉਹ ਮੇਰੇ ਵਾਸਤੇ ਬਹੁਤ ਚੁਣੌਤੀਪੂਰਨ ਸੀਗਾ ਪਰ ਉਹ ਵਧੀਆ ਬਣ ਗਿਆ